ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਕ ਆਰਥਿਕਤਾ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਆਪਾਂ ਸੇਵਿੰਗ ਅਕਾਊਂਟ ਜੋ ਕੀ ਯੂਜ ਹੁੰਦਾ ਉਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਜਾਂ ਵਰਤਿਆ ਜਾਂਦਾ ਵੀ ਬਚਤ ਖਾਤਾ ਉਵੇਂ ਹੀ ਆਪਣੇ ਕੋਲ ਦੂਜਾ ਅਕਾਊਂਟ ਹੁੰਦਾ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਵੀ ਕਰੰਟ ਅਕਾਊਂਟਸ ਉਹਨੂੰ ਕਿਹਾ ਜਾਂਦਾ ਚਾਲੂ ਖਾਤਾ ਫਿਰ ਕਾਊਂਟਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਗਣਨਾ ਫਿਰ ਜੇ ਆਪਾਂ ਉਰੇ ਸੇਵਿੰਗ ਅਕਾਊਂਟ ਕਰੰਟ ਅਕਾਊਂਟਸ ਕਾਊਂਟਿੰਗ ਦੀ ਗੱਲ ਕਰ ਰਹੇ ਹਾਂ ਉਵੇਂ ਹੀ ਫਿਰ ਆਪਾਂ ਇਨਕਮ ਦੀ ਗੱਲ ਕਰਦੇ ਹਾਂ ਇਨਕਮ ਨੂੰ ਪੰਜਾਬੀ 'ਚ ਕਿਹਾ ਜਾਂਦਾ ਆਮਦਨ ਆਮਦਨ ਜਿਵੇਂ ਕਿ ਕਿਉਂਕਿ ਇਹ ਸਾਰਾ ਕੁਛ ਖਰਚ ਦੇ ਹਿਸਾਬ ਨਾਲ ਹੈ ਜੁੜਿਆ ਹੋਇਆ ਤਾਂ ਅਤੇ ਇੱਕ ਵਿਦਡਰੋਅ ਕਹਿੰਦੇ ਹਾਂ ਆਪਾਂ ਤਾਂ ਉਹਦੀ ਥਾਂ 'ਤੇ ਪੰਜਾਬੀ ਵਰਤੀ ਜਾਂਦੀ ਜਿਵੇਂ ਕਿ ਨਿਕਾਸੀ ਵਿਦਡਰੋਅ ਕਰਨਾ ਹੈ ਨਾ ਅਤੇ ਜਮਾਂ ਵੀ ਡਿਪੋਜਿਟ ਕਰਨਾ ਤਾਂ ਇੱਦਾਂ ਦੇ ਇਹ ਕੁਛ ਸ਼ਬਦ ਸੀ ਜੋ ਕਿ ਪੰਜਾਬੀ ਦੇ ਯੂਜ ਕੀਤੇ ਜਾਂਦੇ ਆ